ਹੈਲੋ ਨਮਸਤੇ ਜੀ ਨਮਸਤੇ ਜੀ ਮੈਂ ਅਰੁਣ ਕੁਮਾਰ ਸੁਡਾਣਾ ਬੋਲ ਰਿਹਾ ਫਾਜ਼ਿਲਕਾ ਡਿਸਟ੍ਰਿਕਟ ਤੋਂ ਹਾਂਜੀ ਗੱਲਬਾਤ ਚੱਲੀ ਵੀ ਫਾਜ਼ਿਲਕਾ ਦੀ ਸ ਸੜਕਾਂ ਦੀ ਹਾਲਤ ਬੜੀ ਖਰਾਬ ਹੈ ਯਾਤਾਯਾਤ ਬੜਾ ਕੰਜਸਟਿਡ ਹੋ ਗਿਆ ਹੈ ਅਤੇ ਇੱਥੇ ਵਹੀਕਲ ਦੀ ਸੰਖਿਆ ਵੀ ਬਹੁਤ ਵੱਧ ਗਈ ਹੈ ਸੜਕਾਂ ਛੋਟੀਆਂ ਹਨ ਅਤੇ ਵਹੀਕਲ ਜ਼ਿਆਦਾ ਵੱਧ ਗਏ ਨੇ ਅਤੇ ਰੋਜ਼ ਐਕਸੀਡੈਂਟ ਹੁੰਦੇ ਹਨ ਇੱਥੇ ਭੀੜਾ ਜ਼ਿਆਦਾ ਹੈ ਜਿਵੇਂ ਕਿ ਘੰਟਾਘਰ ਚੌਂਕ ਹੈ ਉੱਥੇ ਵੀ ਬਹੁਤ ਰਸ਼ ਰਹਿੰਦਾ ਹੈ ਹਾਂ ਹਾਂ ਆਮ ਲੋਕਾਂ ਦਾ ਤਾਂ ਬਾਹਰੋਂ ਆਉਣ ਵਾਲੇ ਜਿਹੜੇ ਲੋਕ ਨੇ ਪਿੰਡਾਂ ਵਿੱਚੋਂ ਉਹ ਆਉਂਦੇ ਹਨ ਖਰੀਦਾਰੀ ਕਰਨ ਲਈ ਅਤੇ ਉੱਥੇ ਫਿਰ ਭੀੜਾ ਭ ਵੱਧ ਜਾਂਦਾ ਹੈ ਅਤੇ ਲੰਘਣ ਟੱਪਣ ਨੂੰ ਹੀ ਥਾਂ ਨਹੀਂ ਮਿਲਦੀ ਕਿਉਂਕਿ ਕਾਰਾਂ ਮੋਟਰਸਾਈਕਲ ਬੜੇ ਨੇ ਅਤੇ ਕਈ ਵਾਰੀ ਤਾਂ ਇਹਨਾਂ ਦੇ ਆਪਸ ਵਿੱਚ ਹੀ ਹੋ ਜਾਂਦਾ ਐਕਸੀਡੈਂਟ ਉੱਧਰੋਂ ਬੰਸੀ ਪਕੌੜਿਆਂ ਵਾਲਿਆਂ ਦਾ ਚੌਂਕ ਏ ਉੱਥੇ ਵੀ ਬੜਾ ਰਸ਼ ਰਹਿੰਦਾ ਹਮੇਸ਼ਾ ਹੀ ਰਸ਼ ਰਹਿੰਦਾ ਹੈ ਅਗਾਂਹ ਹਾਂਜੀ ਉਸ ਰੋਡ 'ਤੇ ਅੱਗੇ ਜਾ ਕੇ ਉਹ ਚੌਂਕ ਲਾਈਟਾਂ ਵਾਲਾ ਲਾਈਟਾਂ ਵਾਲੇ ਚੌਂਕ ਵਿੱਚ ਵੀ ਸਾਰਾ ਦਿਨ ਰਸ਼ ਰਹਿਦਾ ਏ ਇੱਕ ਤਾਂ ਉੱਧਰ ਸਕੂਲ ਨੇ ਸਕੂਲ ਵਾਲੇ ਬੱਚਿਆਂ ਨੇ ਆਉਣਾ ਜਾਣਾ ਹੁੰਦਾ ਹੈ ਅਤੇ ਐਕਸੀਡੈਂਟ ਹੋਣ ਦੇ ਚਾਂਸ ਬਹੁਤ ਜ਼ਿਆਦਾ ਨੇ ਪੁਲਿਸ ਵਾਲੇ ਵੀ ਆਪਦੀ ਜੀ ਜਿੰਨੀ ਉਹਨਾਂ ਦੀ ਤਾਕਤ ਹੈ ਉਹ ਸੰਭਾਲਦੇ ਨੇ ਪਰ ਮਤਲਬ ਵੀ ਉਹਨਾਂ ਦੇ ਵੱਸ ਤੋਂ ਵੀ ਬਾਹਰ ਹੈ ਉਹਨਾਂ ਦੇ ਵੱਸ ਤੋਂ ਵੀ ਬਾਹਰ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਵੀ ਕੁਝ ਹੋਰ ਮਤਲਬ ਇੰਤਜ਼ਾਮ ਕਰਨ ਤਾਂ ਕਿ ਸ਼ਹਿਰ ਫੈਲ ਰਿਹਾ ਹੈ ਸੜਕਾਂ ਉਹ ਜਿਹੀਆ ਨੇ ਸੜਕਾਂ ਉਹ ਜਿਹੀਆ ਨੇ ਹਾਂ ਜੀ ਉੱਥੋਂ ਬੱਸ ਸਟੈਂਡ ਵਾਲੇ ਪਾਸੇ ਚਲੇ ਜਾਓ ਤਾਂ ਬੱਸਾਂ ਦਾ ਰਸ਼ ਇਹ ਉੱਥੇ ਵੀ ਖਤਰਾ ਰਹਿੰਦਾ ਹੈ ਹਰ ਵੇਲੇ ਹਰ ਵੇਲੇ ਅਤੇ ਐਕਸੀਡੈਂਟ ਹੋਣ ਦੇ ਚਾਂਸ ਹਮੇਸ਼ਾ ਹੀ ਬੱਚਿਆਂ ਅਤੇ ਬਜ਼ੁਰਗਾਂ ਵਾਸਤੇ ਬਹੁਤ ਹੀ ਔਖਾ ਕੰਮ ਹੈ ਜੀ ਫਾਜ਼ਿਲਕਾ ਜੀ ਡਿਸਟਰਿਕਟ ਦੀ ਹਾਲਾਤ ਮਾੜੇ ਹਨ ਇਹਨੂੰ ਠੀਕ ਹੋਣਾ ਚਾਹੀਦਾ ਸਾਡੀ ਤਾਂ ਇਹੀ ਮਨਸ਼ਾ ਹੈ ਅਸੀਂ ਇਹੀ ਚਾਹੁੰਦੇ ਹਾਂ ਹਾਂਜੀ ਹਾਂ ਚਲੋ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਜੈ ਹਿੰਦ ਹਾਂਜੀ